ਜੇਕਰ ਮੈਂ ਆਪਣੇ ਘਰ ਦੇ ਵਿੱਚ ਗੱਲ ਕਰਾਂ ਮੇਰੇ ਮਾਤਾ ਪਿਤਾ ਦਾਦਾ ਦਾਦੀ ਤਾਂ ਮੰਮੀ ਡੈਡੀ ਦੇ ਨਾਲੋਂ ਦਾਦਾ ਦਾਦੀ ਬਹੁਤ ਘੱਟ ਪੜ੍ਹੇ ਨੇ ਜਾਂ ਦਾਦੀ ਤਾਂ ਮੇਰੇ ਨਹੀਂ ਪੜ੍ਹੇ ਹੋਏ ਅਨਪੜ੍ਹ ਨੇ ਤਾਂ ਮਦਰ ਮੇਰੇ ਮਾਤਾ ਜੀ ਪੜ੍ਹੇ ਨੇ ਦਸ ਅਤੇ ਫਾਦਰ ਵੀ ਪਲੱਸ ਟੂ ਪਾਸ ਨੇ ਤਾਂ ਪਰ ਜੋ ਮੈਂ ਆ ਮੈਂ ਹੁਣ ਐੱਮ ਐੱਸ ਸੀ ਬੀ ਐੱਡ ਕੀਤੀ ਹੋਈ ਹੈ ਤਾਂ ਦੋਨਾਂ ਟਾਈਮ ਦੇ ਵਿੱਚ ਮੇਰੇ ਟਾਈਮ ਦੇ ਵਿੱਚ ਅਤੇ ਮੇਰੇ ਮਦਰ ਦੇ ਟਾਈਮ ਦੇ ਵਿੱਚ ਕਾਫੀ ਫਰਕ ਹੈ ਉਹਨਾਂ ਨੂੰ ਜਦੋਂ ਉਹ ਸਕੂਲ ਜਾਂਦੇ ਹੁੰਦੇ ਸੀ ਬਸ ਇੱਕ ਸਕੂਲ ਤੱਕ ਸੀ ਕੋਲੇਜ ਤੱਕ ਨਹੀਂ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਸ਼ਾਇਦ ਉੱਦਾਂ ਦੀਆਂ ਫੈਸਿਲਿਟੀਜ਼ ਨਹੀਂ ਮਿਲ ਰਹੀਆਂ ਸੀ ਘਰ ਤੋਂ ਕੋਲੇਜ ਤੱਕ ਜਾਣਾ ਬੱਸਿਜ਼ ਵਗੈਰਾ ਨਹੀਂ ਸੀ ਕੋਈ ਹੋਰ ਕੈਬ ਵਗੈਰਾ ਬੁੱਕ ਕਰਕੇ ਨਹੀਂ ਜਾ ਸਕਦੇ ਸੀ ਖੁਦ ਦੀ ਉਹਨਾਂ ਕੋਲ ਕੋਈ ਸਕੂਟੀ ਵਗੈਰਾ ਨਹੀਂ ਸੀ ਬਟ ਜੇਕਰ ਮੈਂ ਦੇਖਾਂ ਤਾਂ ਮੇਰੇ ਕੰਪੈਰੀਜ਼ਨਜ਼ ਮੈਨੂੰ ਹਰ ਇੱਕ ਫੈਸਿਲਿਟੀਜ਼ ਮਿਲੀ ਆ ਮੈਨੂੰ ਮੈਡੀਕਲ ਕੀਤਾ ਹੈ ਮੈਨੂੰ ਪਿੰਡ ਦੇ ਵਿੱਚ ਟਿਊਸ਼ਨਜ਼ ਵੀ ਮਿਲੀ ਆ ਮੈਨੂੰ ਨੀਅਰ ਬਾਏ ਇੱਕ ਕੋਲੇਜ ਵੀ ਸਾਇੰਸ ਕੋਲੇਜ ਮਿਲਿਆ ਜਿੱਥੇ ਮੈਂ ਪੜ੍ਹੀ ਹਾਂ ਤਾਂ ਉਸ ਤੋਂ ਬਾਅਦ ਯੂਨੀਵਰਸਿਟੀ ਵੀ ਮੈਂ ਹੋਸਟਲ 'ਚ ਵੀ ਆਈ ਹਾਂ ਪੜ੍ਹੀ ਹਾਂ ਹੈ ਨਾ ਤਾਂ ਉਸ ਤਰੀਕੇ ਦੇ ਨਾਲ ਇਹ ਸਾਰਾ ਜੇਕਰ ਮੈਂ ਦੇਖਾਂ ਤਾਂ ਮੈਨੂੰ ਓਪਰਚੂਨਿਟੀਜ਼ ਫੈਸਿਲਿਟੀਜ਼ ਜ਼ਿਆਦਾ ਮਿਲੀਆਂ ਨੇ ਐਸ ਕੰਪੇਅਰ ਟੂ ਮੇਰੇ ਮਦਰ ਅਤੇ ਉਸ ਟਾਈਮ ਸ਼ਾਇਦ ਸਿੱਖਿਆ ਨੂੰ ਇੰਨਾ ਵਧੀਆ ਮਤਲਬ ਜਾਂ ਜ਼ਰੂਰੀ ਵੀ ਨਹੀਂ ਸਮਝਿਆ ਜਾਂਦਾ ਸੀ ਮੇਰੇ ਟਾਈਮ ਦੇ ਵਿੱਚ ਪੜ੍ਹਨਾ ਅਤੇ ਇੱਕ ਨੌਕਰੀ ਲੈਣਾ ਜ਼ਿਆਦਾ ਜ਼ਰੂਰੀ ਹੋ ਗਿਆ ਇਹ ਮੈਂ ਡਿਫਰੈਂਸ ਸਮਝਦੀ ਹਾਂ